ਹਾਂਜੀ ਮੈਂ ਫੇਸਬੁਕ ਅਤੇ ਇੰਸਟਾਗਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੀ ਹਾਂ ਮੈਂ ਫੇਸਬੁਕ 'ਤੇ ਕੋਈ ਵੀ ਜਿਵੇਂ ਜ਼ਿਆਦਾ ਚੱਲ ਰਹੀ ਹੋਵੇ ਕੋਈ ਵੀਡੀਓ ਹੋ ਗਈ ਇਹ ਦੇਖਣਾ ਪਸੰਦ ਕਰਦੀ ਹਾਂ ਅਤੇ ਮੈਂ ਜਿਵੇਂ ਮੇਰੇ ਮੇਰੀ ਕੋਈ ਪ੍ਰਾਪਤੀ ਹੋਵੇ ਮੇਰੇ ਬੱਚਿਆਂ ਦੀ ਕੋਈ ਪ੍ਰਾਪਤੀ ਹੋਵੇ ਜਾਂ ਕੋਈ ਖੁਸ਼ੀ ਦਾ ਮੌਕਾ ਹੋਵੇ ਇਹ ਸਭ ਕੁਛ ਮੈਂ ਆਪਦੇ ਫੇਸਬੁਕ ਜੋ ਮੇਰਾ ਬਣਿਆ ਹੋਇਆ ਹੈ ਅਕਾਊਂਟ ਉਹਦੇ ਉੱਤੇ ਪੋਸਟ ਕਰਦੀ ਹਾਂ ਅਤੇ ਕਿਉਂਕਿ ਮੈਂ ਇੱਕ ਜੋਬ ਵੀ ਕਰਦੀ ਹਾਂ ਤਾਂ ਮੇਰੇ ਕੋਲ ਜ਼ਿਆਦਾ ਸਮਾਂ ਤਾਂ ਨਹੀਂ ਹੁੰਦਾ ਇਸ ਨੂੰ ਚਲਾਉਣ ਦੇ ਲਈ ਪਰ ਫਿਰ ਵੀ ਮੈਂ ਵਿੱਚੋਂ ਦਸ ਕੁ ਮਿੰਟ ਹੋ ਗਏ ਪੰਦਰ੍ਹਾਂ ਮਿੰਟ ਹੋ ਗਏ ਚਾਹੇ ਵੀਹ ਮਿੰਟ ਹੋ ਗਏ ਇੰਨਾਂ ਕੁ ਸਮਾਂ ਮੈਂ ਫੇਸਬੁਕ ਅਤੇ ਇੰਸਟਾਗਰਾਮ ਵਰਗੇ ਸੋਸ਼ਲ ਮੀਡੀਆ 'ਤੇ ਇਹਦੇ ਉੱਤੇ ਮੌਕਾ ਇਹਦੇ ਉੱਤੇ ਮੈਂ ਇੰਨਾ ਟਾਈਮ ਦਿੰਦੀ ਹਾਂ ਇੰਨਾਂ ਸਮਾਂ ਇੰਨਾ ਕੁ ਸਮਾਂ ਬਿਤਾਉਂਦੀ ਹਾ ਅਤੇ ਇਸ ਬਾਰੇ ਮੈਂ ਨਾ ਪਸੰਦ ਇਹ ਕਰਦੀ ਹਾਂ ਕਿ ਜਿਵੇਂ ਬੱਚੇ ਅੱਜ ਕੱਲ੍ਹ ਬੱਚਿਆਂ ਦੇ ਵੀ ਛੋਟੇ ਛੋਟੇ ਬੱਚਿਆਂ ਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਬਣੇ ਹੋਏ ਆ ਜੋ ਕਿ ਮੈਨੂੰ ਬਿਲਕੁਲ ਨਹੀਂ ਪਸੰਦ ਕਿ ਜੋ ਪੰਜ ਹੋ ਗਏ ਪੰਜ ਸਾਲ ਦਾ ਬੱਚਾ ਹੋ ਗਿਆ ਛੇ ਸਾਲ ਦੇ ਬੱਚੇ ਅੱਜ ਕੱਲ੍ਹ ਫੇਸਬੁਕ ਇੰਸਟਾਗ੍ਰਾਮ ਟਵੀਟਰ 'ਤੇ ਇਹ ਸਭ 'ਤੇ ਅਕਾਊਂਟ ਬਣਾਈ ਫਿਰਦੇ ਹਨ ਅਤੇ ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਇਲਾਵਾ ਹੋਰ ਮਤਲਬ ਜਿਹਨਾਂ ਦਾ ਧਿਆਨ ਇਹਨਾਂ ਨੂੰ ਨਹੀਂ ਜਾਣਾ ਦੇਣਾ ਚਾਹੀਦਾ ਉਹਦੇ 'ਤੇ ਬਹੁਤ ਸਮਾਂ ਬਤੀਤ ਕਰਦੇ ਹਨ ਅਤੇ ਇਹ ਹੋਰ ਵੀ ਕੋਈ ਚੀਜ਼ਾਂ ਦੇਖਦੇ ਹਨ ਸੋਸ਼ਲ ਮੀਡੀਆ ਉੱਤੇ ਤਾਂ ਉਹਨਾਂ ਜੋ ਉਹਨਾਂ ਨੂੰ ਨਹੀਂ ਵੇਖਣੀਆਂ ਚਾਹੀਦੀਆਂ ਇਹ ਚੀਜ਼ਾਂ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਪਸੰਦ ਨਹੀਂ ਹੈ ਅਤੇ ਹਾਂ ਬਾਕੀ ਜੋ ਛੋਟੀ ਛੋਟੀਆਂ ਖੁਸ਼ੀਆਂ ਹੁੰਦੀਆਂ ਜੋ ਵੱਡੇ ਹੈ ਆਪਣੀਆਂ ਛੋਟੀਆਂ ਛੋਟੀਆਂ ਜੋ ਖੁਸ਼ੀਆਂ ਉਹ ਆਪਦੇ ਫੇਸਬੁੱਕ ਅਕਾਊਂਟ 'ਤੇ ਪੋਸਟ ਕਰਦੇ ਹਨ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਖੁਸ਼ੀ ਮਿਲਦੀ ਹੈ